ਹਾਂਜੀ ਸਰ ਮੈਂ ਨਾ ਅ ਸਿਮਰਨ ਬੋਲ ਰਹੀ ਹਾਂ ਮੇਰੇ ਸਰਵਰ ਡਿਪਾਰਟਮੈਂਟ ਦੇ ਵਿੱਚ ਮੇਰੀ ਡਿਊਟੀ ਲੱਗੀ ਹੈ ਮੈਂ ਸਟੂਡੈਂਟ ਹਾਂ ਅਤੇ ਮੇਰੀ ਉੱਥੇ ਡਿਊਟੀ ਲਗਾਈ ਸੀ ਹਾਂਜੀ ਰੈਸਟੋਰੈਂਟ ਦੇ ਅੰਦਰ ਅਤੇ ਸਰ ਅੱਜ ਕੁਛ ਕਸਟਮਰ ਆਏ ਸੀ ਮੇਰੀ ਆਨ ਡਿਊਟੀ ਦੇ ਵਿੱਚ ਅਤੇ ਮੈਂ ਉਹਨਾਂ ਨੂੰ ਖਾਣਾ ਸਰਵ ਕੀਤਾ ਜਿਸ ਤਰ੍ਹਾਂ ਵੀ ਉਹਨਾਂ ਦੇ ਔਡਰ ਸੀ ਲੇਕਿਨ ਉਹ ਅ ਸੈਟਿਸਫਾਈ ਨਹੀਂ ਹੋਏ ਮੇਰੀ ਸਰਵਿਸ ਤੋਂ ਆਈ ਥਿੰਕ ਅਤੇ ਉਹ ਮੇਰੇ ਨਾਲ ਕਾਫੀ ਰੂਡ ਬੋਲੇ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਬਈ ਮੈਂ ਤੇਰੀ ਮੈਨੇਜਰ ਤੋਂ ਕਰਾਂਗੀ ਸ਼ਿਕਾਇਤ ਕਿ ਤੂੰ ਸਾਨੂੰ ਖਾਣਾ ਠੰਡਾ ਸਰਵ ਕੀਤਾ ਸਰ ਜੋ ਅੰਦਰੋਂ ਬਣ ਕੇ ਆਏਗਾ ਮੈਂ ਉਸੇ ਟਾਈਮ ਤਾਂ ਲੈ ਆਈ ਸੀ ਔਰ ਜੋ ਵੀ ਸ਼ੈਫ ਨੇ ਬਣਾ ਕੇ ਦਿੱਤਾ ਉਹਨਾਂ ਦੇ ਵਿੱਚ ਮੇਰੀ ਤਾਂ ਕੋਈ ਗਲਤੀ ਹੈ ਨਹੀਂ ਮੈਂ ਤਾਂ ਜਸਟ ਸਰਵ ਕੀਤਾ ਉਹਨਾਂ ਨੂੰ ਔਰ ਉਹਨਾਂ ਨੇ ਹਾਂਜੀ ਸਰ ਖਾਣਾ ਸਾਡਾ ਜਿਸ ਤਰ੍ਹਾਂ ਐਜ਼ ਇਟ ਇਜ਼ ਬਣਿਆ ਉਹਨਾਂ ਨੇ ਮੈਂ ਉਸੇ ਟਾਈਮ ਉਹਨਾਂ ਨੂੰ ਦੇ ਦਿੱਤਾ ਖਾਣਾ ਗਰਮ ਸੀ ਨਹੀਂ ਸਰ ਨਹੀਂ ਸਰ ਮੇਰੀ ਕੋਈ ਗਲਤੀ ਨਹੀਂ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਸਰ ਹਾਂਜੀ ਸਰ ਠੀਕ ਹੈ ਸਰ ਥੈਂਕ ਯੂ ਸਰ